ਹਾਂਜੀ ਮੈਂ ਇੱਕ ਪ੍ਰਦਰਸ਼ਨੀ ਦੇ ਵਿਚ ਮੋਡਲ ਬਣਾਉਂਦਾ ਪੇਂਟਿੰਗ ਬਣਾਉਂਦਾ ਪ੍ਰਦਰਸ਼ਨੀ ਵਿਚ ਆਪਣਾ ਘਰ ਅਜਮਾਈ ਹੈ ਉਹ ਉਹਦੇ ਵਿੱਚ ਮੈਨੂੰ ਕਾਫੀ ਕੁਛ ਪ੍ਰਦਰਸ਼ਨੀ 'ਚ ਦਿਖਾਈ ਲੋਕਾਂ ਨੇ ਬਣ ਬਣਾਇਆ ਸੀਗਾ ਜਿਹਦੇ ਵਿੱਚ ਮੈਂ ਵੀ ਆਪਣੀ ਪੇਂਟਿੰਗ ਬਣਾਈ ਪ ਪੇਂਟਿੰਗ ਦੇ ਵਿਚ ਮੈਂ ਦਿਖਇਆ ਹੈ ਕਿ ਇੱਕ ਬੰਦਾ ਆਪਣਾ ਭੇਡਾਂ ਚਾਰਦਾ ਉਹ ਕਿਸ ਤਰੀਕੇ ਨਾਲ ਸਾਰਾ ਦਿਨ ਮਿਹਨਤ ਕਰਦਾ ਅਤੇ ਕਾਫੀ ਕੁਛ ਉਹ 'ਚ ਦੇਖਣ ਨੂੰ ਮਿਲ ਰਿਹਾ ਉਹਦੇ 'ਚ ਮੈਂ ਕਲਰ ਹੀ ਇਹੋ ਜਿਹੇ ਭਰੇ ਕਿ ਕਾਫੀ ਕੁਛ ਲੋਕਾਂ ਨੂੰ ਪਸੰਦ ਆਏ ਵੀ ਉਹ ਕਲਰ ਨਹੀਂ ਕਹਿ ਸਕਦੇ ਮੈਂ ਆਪਣੀ ਰੂਹ ਉਹ 'ਚ ਪਾਈ ਔਰ ਉਹ ਜਿਹੜੀ ਮੈਂ ਪੇਂਟਿੰਗ ਤਿਆਰ ਕੀਤੀ ਉਹ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਸ਼ਹਿਰ ਦੇ ਵਿੱਚ ਰੈਡ ਕ੍ਰੋਸ ਦੇ ਵਿੱਚ ਉਹ ਪੇਂਟਿੰਗ ਹਜੇ ਵੀ ਲੱਗੀ ਹੋਈ ਹੈ ਔਰ ਕਾਫੀ ਕੁਛ ਪ੍ਰਦਰਸ਼ਨੀ ਵਿੱਚ ਦੇਖਣ ਨੂੰ ਮਿਲਿਆ ਔਰ ਇੰਨਜੋਏ ਬਹੁਤ ਕੀਤਾ ਮੈਂ ਮੈਂ ਕਿ ਉਹ ਕਾਫੀ ਲੋਕਾਂ ਨੇ ਪੇਂਟਿੰਗ ਬਣਾਈ ਆ ਔਰ ਕੁਛ ਕਾਫੀ ਕੁਛ ਮੈਨੂੰ ਸਿੱਖਣ ਨੂੰ ਮਿਲਿਆ